ਅੱਜ ਦੇ ਸਮੇਂ ਵਿੱਚ ਤਕਨਾਲੋਜੀ ਇੱਕ ਬਹੁਤ ਵੱਡੀ ਭੂਮਿਕਾ ਨਿਭਾਉਂਦੀ ਆ ਆਪਣੀ ਡੇਲੀ ਲਾਈਫ ਦੇ ਵਿੱਚ ਜਿਵੇਂ ਸਭ ਤੋਂ ਆਪਾਂ ਪਹਿਲਾਂ ਗੱਲ ਕਰੀਏ ਇਹਦੇ ਇਹਦੀਆਂ ਇਗਜਾਮਪਲਸ ਦੀ ਤਾਂ ਸਭ ਤੋਂ ਵੱਡੀ ਉਦਾਹਰਨ ਆਪਣੇ ਸਾਹਮਣੇ ਆ ਫੋਨ ਪਹਿਲਾਂ ਆਪਾਂ ਜੇ ਦੇਖੀਏ ਸੰਚਾਰ ਦੇ ਵਿੱਚ ਬਹੁਤ ਜ਼ਿਆਦਾ ਦਿੱਕਤ ਆਉਂਦੀ ਸੀਗੀ ਆ ਹਲੇ ਥੋੜ੍ਹੇ ਸਾਲ ਪਹਿਲਾਂ ਦੀ ਗੱਲ ਹੀ ਹੈ ਉੱਨੀ ਸੌ ਮਤਲਬ ਆਪਾਂ ਕਹਿ ਲਈਏ ਦੋ ਹਜ਼ਾਰ ਤੋਂ ਪਹਿਲਾਂ ਦੀ ਤਾਂ ਇੰਨੇ ਉਦੋਂ ਫੋਨ ਸੀਗੇ ਜਿਹੜੇ ਹਜੇ ਇੰਨੇ ਆਮ ਨਹੀਂ ਸੀ ਹੋਏ ਤਾਂ ਮੈਨੂੰ ਜਿੱਥੋਂ ਤੱਕ ਯਾਦ ਹੈ ਮਤਲਬ ਇੱਕ ਫੋਨ ਲਈ ਆਪਾਂ ਪੀ ਸੀ ਓ ਤੱਕ ਜਾਂਦੇ ਸੀ ਹੈ ਨਾ ਐਸ ਟੀ ਡੀ ਜਿਹੜੀਆਂ ਕੋਲਸ ਹੁੰਦੀਆਂ ਨੇ ਉਹ ਤਾਂ ਉੱਥੇ ਮਤਲਬ ਆਪਾਂ ਕਹਿ ਲਈਏ ਵੀ ਹੁਣ ਅੱਜ ਕੱਲ੍ਹ ਜਿਵੇਂ ਇੰਨੇ ਮਤਲਬ ਫੋਨ ਹੁਣ ਹਰ ਘਰ ਦੇ ਵਿੱਚ ਮੈਨੂੰ ਲੱਗਦਾ ਜਿੰਨੇ ਜਿੰਨੇ ਮੈਂਬਰ ਆ ਅਤੇ ਉਨੇ ਹੀ ਫੋਨ ਨੇ ਕਿਤੇ ਨਾ ਕਿਤੇ ਦੇਖੀਏ ਆਪਾਂ ਇਹਦੇ ਨਾਲ ਆਪਣੀ ਜਿਹੜੀ ਅ ਜ਼ਿੰਦਗੀ ਆ ਹੈ ਨਾ ਰੋਜ਼ ਮਰਾ ਦੀ ਜ਼ਿੰਦਗੀ ਹੈ ਬਹੁਤ ਆਸਾਨ ਹੋ ਗਈ ਹੈ ਹੁਣ ਆਪਾਂ ਨੂੰ ਮਤਲਬ ਪਹਿਲੀ ਗੱਲ ਆਪਣਾ ਟਾਈਮ ਆ ਜਿਹੜਾ ਬਹੁਤ ਜ਼ਿਆਦਾ ਬਚ ਰਿਹਾ ਹੈ ਨਾ ਹੁਣ ਆਪਾਂ ਆਪਾਂ ਨੂੰ ਕੋਈ ਸੰਚਾਰ ਦੇ ਵਿੱਚ ਕੋਈ ਦਿੱਕਤ ਨਹੀਂ ਆ ਰਹੀ ਆਪਾਂ ਹੁਣ ਦੇਖੋ ਜਿੱਤੇ ਵੀ ਜਿੱਥੇ ਵੀ ਪਹੁੰਚੀਏ ਹੈ ਨਾ ਵੀ ਕਿਤੇ ਵੀ ਹੈ ਬੰਦਾ ਨਾਲ ਦੀ ਨਾਲ ਫੋਨ 'ਤੇ ਦੱਸ ਦਿੰਦਾ ਮੈਂ ਹੁਣ ਇੱਥੇ ਪਹੁੰਚ ਗਿਆ ਹੁਣ ਇਹ ਹੋ ਰਿਹਾ ਤਾਂ ਜਿਹੜੇ ਬਹੁਤ ਅੱਜ ਕੱਲ੍ਹ ਦੇ ਜਿਹੜੇ ਕੰਮ ਨੇ ਬਹੁਤ ਆਸਾਨ ਹੋ ਗਏ ਨੇ ਤਾਂ ਹੋਰ ਵੀ ਆਪਾਂ ਹੁਣ ਦੇਖੀਏ ਵੀ ਟਾਈਮ ਦੇ ਨਾਲ ਨਾਲ ਔਨਲਾਈਨ ਬਹੁਤ ਸਾਰੀਆਂ ਇਹੋ ਜਿਹੀਆਂ ਐਪਸ ਖੁੱਲ੍ਹ ਗਈਆਂ ਨੇ ਹੈ ਨਾ ਜਿਵੇਂ ਜਿਹਦੇ ਨਾਲ ਆਪਾਂ ਨੂੰ ਆਪਾਂ ਕਰੀਏ ਆਪਣੀ ਸਿਹਤ ਪੱਖੋਂ ਆਪਾਂ ਨੂੰ ਬਹੁਤ ਫਾਇਦਾ ਜਾਂ ਹੋਰ ਵੀ ਮਤਲਬ ਵੀ ਬਹੁਤ ਪੜ੍ਹਾਈ ਪੱਖੋਂ ਤਾਂ ਚਲੋ ਹੈਗੇ ਹੀ ਹੈਗੇ ਨੇ ਤਾਂ ਬਹੁਤ ਜ਼ਿਆਦਾ ਫਾਇਦੇ ਨੇ ਹੁਣ ਜਿੱਦਾਂ ਆਪਾਂ ਜੇ ਸਿਹਤ ਪੱਖੋਂ ਵੇਖੀਏ ਤਾਂ ਸਿਹਤ ਸਿਹਤ ਦੇ ਨਾਲ ਸੰਬੰਧਿਤ ਅੱਜ ਕੱਲ੍ਹ ਬਹੁਤ ਸਾਰੀਆਂ ਐਪਸ ਖੁੱਲ੍ਹ ਗਈਆਂ ਨੇ ਤਾਂ ਉਹਦੇ ਵਿਚ ਕੀ ਹੈ ਵੀ ਆਪਾਂ ਡੇਲੀ ਟੂ ਡੇਲੀ ਆਪਣਾ ਵੀ ਉਹ ਆਪਾਂ ਨੂੰ ਸਾਰਾ ਦੱਸ ਦਿੰਦਾ ਹੈ ਵੀ ਆਪਣੀਆਂ ਇੰਨੀਆਂ ਕੈਲਰੀ ਕ ਬਰਨ ਹੋ ਗਈਆਂ ਅੱਜ ਦੀਆਂ ਹੈ ਨਾ ਵੀ ਇੰਨੀ ਤੁਹਾਨੂੰ ਹੋਰ ਤੁਹਾਨੂੰ ਕੈਲਰੀ ਦੀ ਲੋੜ ਹੈ ਤੁਹਾਡੇ ਅੱਜ ਇੰਨੇ ਸਟੈਪ ਖਤਮ ਹੋ ਗਏ ਆ ਅਤੇ ਤੁਹਾਨੂੰ ਇੰਨੇ ਸਟੈਪਾਂ ਦੀ ਹੋਰ ਲੋੜ ਹੈ ਤਾਂ ਕਿਤੇ ਨਾ ਕਿਤੇ ਕੀ ਹੈ ਇਹਦੇ 'ਚ ਆਪਾਂ ਦੇਖੋ ਪਤਾ ਤਾਂ ਆਪਾਂ ਸਭ ਨੂੰ ਹੀ ਹੈ ਵੀ ਇੰਨੇ ਵੀ ਇਹਦਾ ਵੀ ਕੀ ਆਪਣੀ ਉਹਦੇ 'ਤੇ ਪ੍ਰਭਾਵ ਪੈ ਰਿਹਾ ਸਿਹਤ ਦੇ ਉੱਤੇ ਪਰ ਕਿਤੇ ਨਾ ਕਿਤੇ ਇਹ ਐਪ ਦੇ ਨਾਲ ਇੱਕ ਆਪਾਂ ਨੂੰ ਇੱਕ ਐਜ਼ ਅ ਰੀਮਾਈਂਡਰ ਹੈ ਨਾ ਰੀਮਾਈਂਡਰ ਮਤਲਬ ਵੀ ਆਪਾਂ ਨੂੰ ਇੱਕ ਵੀ ਯਾਦ ਰਹਿ ਜਾਂਦਾ ਇਹਦੇ ਨਾਲ ਹੈ ਨਾ ਵੀ ਪਤਾ ਤਾਂ ਆਪਾਂ ਨੂੰ ਸਭ ਨੂੰ ਹੀ ਹੈ ਪਰ ਇਹ ਕਿਤੇ ਨਾ ਕਿਤੇ ਵੀ ਆਪਾਂ ਨੂੰ ਯਾਦ ਕਰਵਾਉਣ ਦੇ ਵਿੱਚ ਵੀ ਮਦਦ ਉਹ ਕਰਦੀ ਹੈ ਬਾਕੀ ਇਹਦੇ ਵਿੱਚ ਤੁਸੀਂ ਦੇਖੋ ਡਾਟਾ ਪੂਰਾ ਸਟੋਰ ਰਹਿੰਦਾ ਤਾਂ ਉਹ ਵੀ ਇੱਕ ਬਹੁਤ ਵੱਡੀ ਮਤਲਬ ਪੋਜ਼ੀਟਿਵ ਚੀਜ਼ ਹੈ ਇਹ ਉਹਦੀ ਤਾਂ ਬਹੁਤ ਸਾਰੀਆਂ ਮਤਲਬ ਉਦਾਹਰਨਾਂ ਨੇ ਇੱਦਾਂ ਜਿਹਦੇ ਨਾਲ ਇਹ ਤਕਨਾਲੋਜੀ ਨੇ ਆਪਣੀ ਜਿਹੜੀ ਰੋਜ਼ ਦੀ ਜ਼ਿੰਦਗੀ ਹੈ ਇਹਨੂੰ ਬਹੁਤ ਆਸਾਨ ਬਣਾਇਆ ਹੋਇਆ